ਗੋਡਿਆਂ ਦਾ ਦਰਦ ਦੀ ਸਮੱਸਿਆ ਬਹੁਤ ਹੀ ਆਮ ਹੋ ਚੁੱਕੀ ਹੈ ਇਸ ਦੀ ਪਰੇਸ਼ਾਨੀ ਨਾ ਕੇਵਲ ਅ ਬਜ਼ੁਰਗਾਂ ਤੱਕ ਹੈ ਇੱਕ ਕਮ ਉਮਰ ਦੇ ਬੱਚਿਆਂ ਦੇ ਵਿੱਚ ਵੀ ਆ ਚੁੱਕੀ ਹੈ ਸਾਡੇ ਪਿੰਡ ਵਿੱਚ ਕਾਫੀ ਵੇਦ ਵੇਦ ਹਕੀਮ ਹਨ ਜਿਹੜੇ ਗੋਡਿਆਂ ਦਾ ਇਲਾਜ ਕਰਦੇ ਹਨ ਉਹਨਾਂ ਕੋਲ ਇੱਕ ਸਪੈਸ਼ਲ ਟਾਈਪ ਦਾ ਤੇਲ ਹੁੰਦਾ ਹੈ ਜਿਸ ਕਰਕੇ ਉਹ ਜਿਸ ਨਾਲ ਮਾਲਿਸ਼ ਕਰਨ ਨਾਲ ਗੋਡੇ ਦਾ ਦਰਦ ਸਹੀ ਹੋ ਜਾਂਦਾ ਹੈ ਅਤੇ ਕਾਲੀ ਮਿਰਚ ਦੇ ਦਾਣੇ ਅਤੇ ਮਿਕਸੀ ਵਿੱਚ ਪੀਸ ਕਰ ਇੱਕ ਪਾਊਡਰ ਵੀ ਬਣਾਉਂਦੇ ਹਨ ਜਿਸ ਨੂੰ ਡੇਲੀ ਦੁੱਧ ਨਾਲ ਪੀਣਾ ਹੁੰਦਾ ਹੈ ਅਤੇ ਗੋਡਿਆਂ ਦਾ ਦਰਦ ਸਹੀ ਹੋ ਜਾਂਦਾ ਹੈ ਅਤੇ ਸਾਡੇ ਪਿੰਡ ਵਿੱਚ ਵੈਦ ਅਤੇ ਹਕੀਮ ਗੋਡਿਆਂ ਦੀ ਮਾਲਿਸ਼ ਵੀ ਕਰਦੇ ਹਨ ਅਤੇ ਉਹਨਾਂ ਦੀ ਮਾਲਿਸ਼ ਕਰਨ ਦਾ ਤਰੀਕਾ ਕਾਫੀ ਵੱਖ ਹੈ ਜੋ ਕਿ ਇੱਕ ਆਮ ਇਨਸਾਨ ਨਹੀਂ ਕਰ ਸਕਦਾ ਸਾਡੇ ਪਿੰਡ ਦੇ ਬਜ਼ੁਰਗ ਬੱਚੇ ਜਦੋਂ ਵੀ ਗੋਡੇ ਦੀ ਦਰਦ ਦੀ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਹਨ ਤਾਂ ਉਹ ਉਹਨਾਂ ਹਕੀਮ ਤੇ ਹਕੀਮਾਂ ਕੋਲ ਜਾਂਦੇ ਹਨ ਜਿਸ ਕਰਕੇ ਉਹ ਹਫ਼ਤੇ ਪੰਜ ਸੱਤ ਦਿਨ ਤੱਕ ਠੀਕ ਹੋ ਜਾਂਦੇ ਹਨ ਧੰਨਵਾਦ